ਸਰਕਾਰ ਮੇਰੇ ਖੇਤਰ ਦੇ ਵਿੱਚ ਕਾਫੀ ਕੈਂਪਸ ਲਗਾਉਂਦੀ ਹੈ ਕੁਛ ਕੈਂਪਸ ਕੋਲਜਿਸ ਵਿੱਚ ਲੱਗਦੇ ਨੇ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਇਜਨੇਅਰਿੰਗ ਕੋਲਜ ਫਤਹਿਗੜ੍ਹ ਸਾਹਿਬ ਉੱਥੇ ਜ ਜੂਨ ਅਤੇ ਜੁਲਾਈ ਵਿੱਚ ਇੱਕ ਬਲੱਡ ਕੈਂਪ ਲੱਗਿਆ ਸੀ ਜੋ ਕਿ ਡਾਕਟਰਸ ਦੇ ਨਾਲ ਸੁਪਰਵਾਈਜਡ ਸੀ ਕਾਫੀ ਬੱਚਿਆਂ ਨੇ ਉਹਦੇ ਅੰਦਰ ਪਾਰਟੀਸਪੇਟ ਕੀਤਾ ਅਤੇ ਖੂਨਦਾਨ ਕੈਂਪ ਦੇ ਵਿੱਚ ਉਹਨਾਂ ਨੇ ਕਾਫੀ ਖੂਨ ਡੋਨੇਟ ਕੀਤਾ ਅਤੇ ਹਰ ਬਲੱਡ ਟਾਈਪ ਡੋਨੇਟ ਹੋਇਆ ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਕੋਲਜ ਨੂੰ ਛੱਡ ਕੇ ਇੱਕ ਮਾਤਾ ਗੁਜਰੀ ਕਾਲਜ ਦੇ ਅੰਦਰ ਵੀ ਕੈਮਸ ਲਗਾਏ ਗਏ ਉਹ ਸਿਰਫ ਬਲੱਡ ਕੈਂਪਸ ਨਹੀਂ ਸਨ ਉਹਨਾਂ ਦੇ ਅੰਦਰ ਹੋਰ ਵੀ ਕਾਫੀ ਇਨਫੋਰਮੇਸ਼ਨ ਦਿੱਤੀ ਗਈ ਸੀ ਰਾਜਪੁਰਾ ਕੋਲਜ ਤੋਂ ਕਾਫੀ ਡਾਕਟਰਸ ਆਏ ਸੀ ਜੋ ਕਿ ਮੈਡੀਕਲ ਕੋਲਜ ਦੇ ਸੀ ਅਤੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਕਾਫੀ ਦਵ ਦਵਾਈਆਂ ਅਤੇ ਬਿਮਾਰੀਆਂ ਬਾਰੇ ਦੱਸਿਆ ਉਨ੍ਹਾਂ ਨੇ ਇਹ ਵੀ ਸਮਝਾਇਆ ਵੀ ਕਿਹੜੀ ਬਿਮਾਰੀ ਦੇ ਵਿੱਚ ਆਪਾਂ ਕਿਹੜੀ ਦਵਾਈ ਲੈ ਸਕਦੇ ਹਾਂ ਅਤੇ ਕਿਹੜੇ ਸਿਮਟਮਸ ਤੋਂ ਬਾਅਦ ਆਪਾਂ ਨੂੰ ਡਾਕਟਰ ਕੋਲ ਜਾਣਾ ਜ਼ਰੂਰੀ ਹੁੰਦਾ ਹੈ ਬੱਚਿਆਂ ਨੇ ਪ੍ਰੋਗਰਾਮ ਕਾਫੀ ਧਿਆਨ ਨਾਲ ਸੁਣਿਆ ਅਤੇ ਉਹਨਾਂ ਨੂੰ ਕਾਫੀ ਕੁਝ ਪਤਾ ਲੱਗਿਆ ਉਸ ਤੋਂ ਬਾਅਦ ਜਿਹੜੇ ਡਾਕਟਰਸ ਦੀ ਟੀਮ ਸੀਗੀ ਉਹ ਕੋਲਜਿਸ ਦੇ ਨਾਲ ਨਾਲ ਸਕੂਲਸ ਦੇ ਅੰਦਰ ਵੀ ਗਏ ਐੱਮ ਜੀ ਅਸ਼ੋਕਾ ਗਰਲਸ ਸਕੂਲ ਦੇ ਵਿੱਚ ਲੇਡੀ ਡਾਕਟਰ ਗਏ ਅਤੇ ਉਹਨਾਂ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਕਾਫੀ ਕੁਛ ਸਮਝਾਇਆ ਅਤੇ ਕਾਫੀ ਕੁਛ ਦੱਸਿਆ ਉਹਨਾਂ ਨੇ ਹਰ ਚੀਜ਼ ਕਵਰ ਕੀਤੀ ਜੋ ਕਿ ਉਹਨਾਂ ਨੂੰ ਲੱਗਿਆ ਵੀ ਬੱਚਿਆਂ ਨੂੰ ਜਾਣਨਾ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜੀ ਡਾਕਟਰਸ ਦੀ ਟੀਮ ਸੀ ਉਸਨੇ ਬੋਆਏ ਸਕੂਲਸ ਦੇ ਅੰਦਰ ਵੀ ਕੈਂਪ ਲਗਵਾਏ ਅਤੇ ਉਸ ਬੋਆਏ ਸਕੂਲਸ ਦੇ ਅੰਦਰ ਵੀ ਡੋਨੇਸ਼ਨ ਕੈਂਪ ਲੱਗੇ ਪ੍ਰੈਜੈਂਟੇਸ਼ਨ ਹੋਈਆਂ ਅਤੇ ਮੀਟਿੰਗਸ ਹੋਈਆਂ ਅਤੇ ਡਾਕਟਰ ਨੇ ਟੀਚਰਸ ਨੂੰ ਵੀ ਸਮਝਾਇਆ ਵੀ ਆਪਣੀ ਮੈਂਟਲ ਹੈਲਥ ਕਿੰਨੀ ਜ਼ਰੂਰੀ ਹੈ ਅਤੇ ਉਸ ਦੇ ਨਾਲ ਬੱਚਿਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ